ਮੈਨੂੰ ਭਾਰਤ ਗੈਸ ਸਿਲੰਡਰ ਵਾਲਿਆਂ ਨੇ ਇੱਕ ਸਕੀਮ ਵਿੱਚ ਨਵਾਂ ਰੈਗੂਲੇਟਰ ਫਰੀ ਵਿੱਚ ਦਿੱਤਾ ਹੈ ਮੈਂ ਗੈਸ ਏਜੰਸੀ ਵਾਲਿਆਂ ਦੀ ਇਹ ਸ਼ਲਾਘਾ ਕਰਦੀ ਹਾਂ ਕਿ ਉਹਨਾਂ ਨੇ ਇਹ ਟੀਚਾ ਚ ਅਪਣਾਇਆ ਹੈ ਕਿ ਜਿਨ੍ਹਾਂ ਦੇ ਗੈਸ ਰੈਗੂਲੇਟਰ ਦਸ ਸਾਲ ਤੋਂ ਪੁਰਾਣੇ ਹੋ ਚੁੱਕੇ ਹਨ ਉਹਨਾਂ ਨੂੰ ਅਸੀਂ ਫਰੀ ਗੈਸ ਰੈਗਲੇਟਰ ਦੇਵਾਂਗੇ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਮੈਂ ਬਹੁਤ ਹੀ ਇਹਨਾਂ ਦੇ ਕਦਮ ਤੋਂ ਪ੍ਰਭਾਵਿਤ ਹੋਈ ਹਾਂ ਕਿ ਇਹਨਾਂ ਨੇ ਘਰ ਵਿੱਚ ਰਹਿਣ ਵਾਲੀਆਂ ਇਸਤਰੀਆਂ ਬਾਰੇ ਸੋਚਿਆ ਹੈ ਕਿਉਂਕਿ ਗੈਸ ਰੈਗੁਲੇਟਰ ਖ਼ਰਾਬ ਹੋਣ ਕਰਕੇ ਵੀ ਬਹੁਤ ਹਾਦਸੇ ਹੁੰਦੇ ਹਨ ਇਸ ਗੈਸ ਰੈਗੂਲੇਟਰ ਦੇ ਚੇਂਜ ਕਰਨ ਦੇ ਨਾਲ ਗੈਸ ਵੀ ਹਿਸਾਬ ਦੀ ਨਿਕਲਦੀ ਹੈ ਪੁਰਾਣੇ ਗੈਸ ਰੈਗੂਲੇਟਰਾਂ ਦੇ ਵਿੱਚ ਗੈਸ ਜ਼ਿਆਦਾ ਫਾਸਟ ਨਿਕਲਦੀ ਹੈ ਇਹਦੇ ਨਾਲ ਜਿਹੜੀ ਹੈ ਕਿ ਗੈਸ ਦੀ ਵੀ ਬਚਤ ਹੋਵੇਗੀ ਅਤੇ ਉਹ ਜਿਹੜੀਆਂ ਘਰ ਦੀਆਂ ਜਨਾਨੀਆਂ ਨੇ ਉਹ ਵੀ ਸੇਫ ਰਹਿਣਗੀਆਂ ਮੈਂ ਬਹੁਤ ਹੀ ਸ਼ਲਾਘਾ ਕਰਦੀ ਹਾਂ